ਖੇਤੀ ਮੱਛੀ ਪਾਲਣ ਪਸ਼ੂ ਪਾਲਣ ਡੇਰੀ ਉਤਪਾਦਨ ਇਹ ਸਾਡਾ ਮੁੱਖ ਕੰਮ ਹੈ ਅਤੇ ਅੱਜ ਕੱਲ੍ਹ ਜਿਵੇਂ ਪਹਿਲਾਂ ਖੇਤੀ ਵਿੱਚ ਹੀ ਜਾਂ ਮੱਛੀ ਪਾਲਣ ਜਾਂ ਪਸ਼ੂ ਪਾਲਣ ਵਿੱਚ ਇੰਨੀ ਸਾਰੀ ਟੈਕਨੋਲੋਜੀ ਨਹੀਂ ਹੁੰਦੀ ਸੀ ਪਰ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਦਿਨ ਬ ਦਿਨ ਵਧੀ ਜਾ ਰਹੀ ਹੈ ਪਹਿਲਾਂ ਕੀ ਸੀਗਾ ਕਿ ਖੇਤੀ ਵਿੱਚ ਸਾਡੇ ਕੋਲ ਕਾ ਮਸ਼ੀਨਾਂ ਨਹੀਂ ਸੀ ਜਿਸ ਕਰਕੇ ਸਾਨੂੰ ਖੇਤੀ ਜਦੋਂ ਕੱਟਣੀ ਹੁੰਦੀ ਸੀ ਫਸਲ ਕੱਟਣੀ ਹੁੰਦੀ ਸੀ ਸਾਨੂੰ ਬਹੁਤ ਜ਼ਿਆਦਾ ਮਿਹਨਤ ਲੱਗਦੀ ਸੀ ਪਰ ਅੱਜ ਕੱਲ੍ਹ ਕੀ ਆ ਮਸ਼ੀਨਾਂ ਆ ਗਈਆਂ ਜਿਸ ਕਰਕੇ ਸਾਨੂੰ ਇੰਨੀ ਮਿਹਨਤ ਨਹੀਂ ਲਗਾਉਣੀ ਪੈਂਦੀ ਅਤੇ ਅਸੀਂ ਬਹੁਤ ਹੀ ਜਲਦੀ ਆਪਣੀ ਫਸਲ ਕੱਟ ਸਕਦੇ ਹਾਂ ਖੇਤੀ ਇਹਦੇ ਵਿੱਚ ਵੀ ਮਦਦ ਕਰਦੀ ਹੈ ਅਤੇ ਇਹਦੇ ਵਿੱਚ ਜਿਵੇਂ ਆਪਣੇ ਕੋਲ ਅੱਜ ਕੱਲ੍ਹ ਬਹੁਤ ਜ਼ਿਆਦਾ ਪੈਸਟੀਸਾਈਡ ਅਤੇ ਫਰਟੀਲਾਈਜਰ ਆ ਚੁੱਕੇ ਹੈ ਜਿਹਦੇ ਨਾਲ ਆਪਣਾ ਅਪ ਅਸੀਂ ਆਪਣੀ ਜ਼ਮੀਨ ਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਵਧਾ ਸਕਦੇ ਹਾਂ ਜ਼ਮੀਨ ਦੀ ਪੈਦਾਵਾਰ ਵਧਣ ਕਾਰਨ ਸਾਡੀ ਆਰਥਿਕ ਸਥਿਤੀ ਚੰਗੀ ਹੁੰਦੀ ਹੈ ਕਿਉਂਕਿ ਆਰਥਿਕ ਸਥਿਤੀ ਤਾਂ ਹੀ ਚੰਗੀ ਹੋਵੇਗੀ ਜੇ ਸਾਡੀ ਫਸਲ ਬਹੁਤ ਜ਼ਿਆਦਾ ਵਿਕੇਗੀ ਮੱਛੀ ਪਾਲਣ ਵਿੱਚ ਵੀ ਇਹ ਹੀ ਚੀਜ਼ ਹੈ ਕਿ ਜਿਵੇਂ ਟੈਕਨੋਲੋਜੀ ਆ ਗਈ ਆ ਉਹਦੇ ਵਿੱਚ ਵੀ ਕਾਫ਼ੀ ਵਧੀਆ ਬਣਿਆ ਆ ਡੇਰੀ ਉਤਪਾਦਨ ਡੇਰੀ ਹੁਣ ਡੇਰੀ ਦੇ ਪ੍ਰੋਡਕਟ ਜਿਹੜੇ ਆ ਸਾਡੇ ਵਾਸਤੇ ਬਹੁਤ ਹੀ ਜ਼ਰੂਰੀ ਹੈ ਜਿਵੇਂ ਦੁੱਧ ਹੋ ਗਿਆ ਦਹੀਂ ਹੋ ਗਿਆ ਇਹ ਸਭ ਡੇਰੀ ਪ੍ਰੋਡਕਟ ਹਨ ਇਹਦੇ ਨਾਲ ਸਾਡੀ ਟੈਕਨੋਲੋਜੀ ਕਰਕੇ ਸਾਡੇ ਡੇਰੀ ਜਿਹੜੀ ਪ੍ਰੋਡਕਟ ਹੈ ਉਹ ਲਗਾਤਾਰ ਵੱਧਦੀ ਵ ਪੈਦਾਵਾਰ ਵੱਧਦੀ ਜਾ ਰਹੀ ਹੈ ਜਿਸ ਕਰਕੇ ਸਾਡੀ ਮਤਲਬ ਸਾਨੂੰ ਟ ਟਾਈਮ ਸਿਰ ਸਮੇਂ ਸਿਰ ਉਹ ਮਿਲਦਾ ਸਾਰਾ ਮਿਲ ਦੁੱਧ ਦਹੀਂ ਮੱਖਣ ਘਿਓ ਇਹ ਸਭ ਚੀਜ਼ਾਂ ਮਿਲਦੀਆਂ ਹਨ ਸ ਖੇਤੀ ਟੈਕਨੋਲੋਜੀ ਵਿ ਵਧਣ ਕਾਰਨ ਸਾਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਇਆ ਹੈ